ਸਾਡੇ ਏਰੀਏ ਦਾ ਮੌਸਮ ਬਹੁਤ ਖਰਾਬ ਰਹਿੰਦਾ ਹੈ ਕਦੇ ਪਤਾ ਨਹੀਂ ਲਗਦਾ ਕਦ ਧੁੱਪ ਆਉਣੀ ਹੇੈ ਕਦ ਬਾਰਿਸ਼ ਹੋਣੀ ਹੈ ਸਾਡੇ ਏਰੀਏ ਦੇ ਨਾਲ ਹਿੱਲ ਸਟੇਸ਼ਨ 'ਤੇ ਸਤਲੁਜ ਦਰਿਆ ਲਗਦਾ ਹੈ ਲੋਕ ਦਰਖਤ ਜ਼ਿਆਦਾ ਲਗਾਉਂਦੇ ਹਨ ਜਿਸ ਨਾਲ ਮੀਂਹ ਦਾ ਮੌਸਮ ਬਣਿਆ ਰਹਿੰਦਾ ਹੈ ਮੌਸਮ ਗਰਮੀ ਤੋਂ ਰਾਹਤ ਮਿਲਦੀ ਰਹਿੰਦੀ ਹੈ ਬਾਕੀ ਸ਼ਹਿਰਾਂ ਨਾਲੋਂ ਸਾਡੇ ਸ਼ਹਿਰ ਦਾ ਤਾਪਮਾਨ ਵਧੀਆ ਹੈ